ਮੈਂ ਪਹਿਲਾਂ ਪ੍ਰੀਤ ਰੈਸਟੋਰੈਂਟ ਤੋਂ ਭੋਜਨ ਔਡਰ ਕਰਦੀ ਹੁੰਦੀ ਸੀ ਜੇ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਜੇ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਖਾਣ ਪੀਣ ਸੰਬੰਧੀ ਸਮੱਗਰੀ ਤਾਂ ਮੈਂ ਪ੍ਰੀਤ ਰੈਸਟੋਰੈਂਟ ਤੋਂ ਔਡਰ ਕਰਦੀ ਹੁੰਦੀ ਸੀ ਅਤੇ ਫਿਰ ਇੰਨਾਂ ਜ਼ਿਆਦਾ ਸਮਾਂ ਔਡਰ ਕਰਨ ਤੋਂ ਬਾਅਦ ਜਦੋਂ ਮੈਂ ਦੁਬਾਰਾ ਕੁਛ ਵੀ ਚੀਜ਼ ਔਡਰ ਹੁਣ ਕਰਦੀ ਸੀ ਤਾਂ ਉਹਨਾਂ ਨੂੰ ਮੇਰਾ ਉਹਨਾਂ ਨੂੰ ਮੇਰਾ ਪਤਾ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਸੀ ਕਿਉਂਕਿ ਉਹ ਮੇਰੇ ਪਤੇ ਤੋਂ ਪਹਿਲਾਂ ਹੀ ਜਾਣੂ ਸੀ ਅਤੇ ਇਸ ਲਈ ਉਹਨਾਂ ਨੂੰ ਨਵਾਂ ਪਤਾ ਦੱਸਣ ਦੀ ਕੋਈ ਜ਼ਰੂਰਤ ਨਹੀਂ ਸੀ ਪੈਂਦੀ ਪਰ ਹੁਣ ਮੈਂ ਆਪਣੀ ਰਿਸ਼ਤੇਦਾਰੀ ਜੋ ਕਿ ਹਰਗਣਾਂ ਦੇ ਵਿੱਚ ਹੈ ਉੱਥੇ ਮੈਂ ਆਈ ਹੋਈ ਹਾਂ ਅਤੇ ਉਹ ਫਿਰ ਮੈਂ ਉੱਥੋਂ ਪ੍ਰੀਤ ਰੈਸਟੋਰੈਂਟ ਤੋਂ ਮੈਂ ਭੋਜਨ ਔਡਰ ਕਰਨਾ ਚਾਹੁੰਦੀ ਹਾਂ ਅਤੇ ਇਸਦੇ ਲਈ ਮੈਂ ਰੈਸਟੋਰੈਂਟ ਵਾਲਿਆਂ ਕੋਲ ਨਵਾਂ ਜੇ ਕੋਈ ਪਤਾ ਏ ਉਹ ਉਹਨਾਂ ਨੂੰ ਮੈਂ ਦੇਣਾ ਚਾਹੁੰਦੀ ਹਾਂ ਅਤੇ ਉਹ ਇਹ ਸਾਰਾ ਐਡਰੈੱਸ ਆਪਣੀ ਸੂਚੀ ਦੇ ਵਿੱਚ ਸ਼ਾਮਿਲ ਕਰ ਲੈਣ ਤਾਂ ਜੋ ਮੈਨੂੰ ਆਪਣਾ ਔਡਰ ਸਮੇਂ ਸਿਰ ਮਿਲ ਸਕੇ